ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਤਲਬ ਬਰਨਾਲਾ ਵੀਲੇਸ ਬਿਲੋਂਗ ਕਰਦੀ ਹਾਂ ਮੈਨੂੰ ਅ ਮਤਲਬ ਤੁਹਾਡੇ ਸ਼ਰਮਾ ਸਟੋਰ 'ਚ ਮੂਵੀ ਦੇਖਣ ਲਈ ਲਾਇਕ ਸ਼ੋਅ ਚਾਹੀਦਾ ਹੈ ਅਤੇ ਮੈਂ ਆਪਣੇ ਨਾਇਟ ਸ਼ੋਅ ਲਈ ਆਪਣੇ ਪਰਿਵਾਰ ਨੂੰ ਮੂਵੀ ਦੇਖਣ ਲਈ ਅ ਤੁਹਾਡੇ ਮਤਲਵ ਸਿਨੇਮਾ ਹੋਲ ਵਿੱਚ ਮੂਵੀ ਦਿਖਾਉਣਾ ਚਾਹੁੰਦੀ ਹਾਂ ਇਸ ਲਈ ਮੈਨੂੰ ਟਿਕਟਾਂ 'ਤੇ ਅਹ ਟਿਕਟਾਂ 'ਤੇ ਸੀਟਾਂ ਬੁੱਕ ਕਰਵਾਉਣ ਲਈ ਅਹ ਮਤਲਬ ਉਹ ਦਿੱਤੀ ਜਾਵੇ ਐਂਟਰੀ ਦਿੱਤੀ ਜਾਵੇ ਅਤੇ ਤਾਂ ਕਿ ਜੋ ਮੈਂ ਜਲਦੀ ਤੋਂ ਜਲਦੀ ਸਿਨੇਮਾ ਹੋਲ ਵਿੱਚ ਆਪਣੀ ਮਤਲਵ ਟ੍ਰੇਨਿੰਗ ਟ੍ਰੇਨਿੰਗ ਨਹੀਂ ਭਾਵ ਉਹ ਮੈਂ ਸੀਟਾਂ ਪਿੱਛੇ ਬੈਠਣਾ ਪਸੰਦ ਕਰਦੀ ਹਾਂ ਅਤੇ ਉੱਥੇ ਵਧੀਆ ਮਾਹੌਲ ਬੈਠਾ ਬੈਠਣਾ ਪਸੰਦ ਕਰਦੀ ਹਾਂ ਤਾਂ ਕਿ ਮੇਰੇ ਪਰਿਵਾਰ ਨੂੰ ਸਿਨੇਮਾ ਮਤਲਬ ਹਾਲ ਵਿੱਚ ਮੂਵੀ ਦੇਖਣ ਵਿੱਚ ਕੋਈ ਵੀ ਰੁਕਾਵਟ ਪੈਦਾ ਨਾ ਹੋਵੇ ਇਸ ਲਈ ਮੈਂ ਤੁਹਾਡੇ ਤੋਂ ਇਹ ਹੀ ਬਿਲੋਂਗ ਕਰਨਾ ਚਾਹੁੰਦੀ ਹਾਂ ਕਿ ਮੈਂ ਆਪਣੇ ਪਰਿਵਾਰ ਨਾਲ ਤੁਹਾਡੇ ਸਿਨਮਾਂ ਵਿੱਚ ਐਂਟਰੀ ਲੈ ਸਕਦੀ ਹਾਂ ਅਤੇ ਮੈਨੂੰ ਟਿਕਟਾਂ 'ਤੇ ਹੋਰ ਖਾਣਾ ਪੀਣ ਦਾ ਸਮਾਨ ਵਧੀਆ ਹੋਣਾ ਚਾਹੀਦਾ ਹੈ ਅਤੇ ਮੈਨੂੰ ਸੀਟਾਂ ਨੀਚੇ ਨਹੀਂ ਉਹ ਵੱਧ ਉੱਪਰਲੀ ਸੀਟਾਂ 'ਤੇ ਹੀ ਬਣਾ ਬੈਠਣਾ ਪਸੰਦ ਕਰਦੀ ਹਾਂ ਤਾਂ ਜੋ ਕਿ ਮੇਰੇ ਪਰਿਵਾਰ ਨੂੰ ਸ ਮੂਵੀ ਦੇਖਣ ਵਿੱਚ ਕੋਈ ਵੀ ਪਰੇਸ਼ਾਨੀ ਨਾ ਹੋਵੇ ਥੈਂਕ ਯੂ ਸ਼ਰ